ਪਹਿਲੀ ਵਾਰ ਮੈਂ ਆਪਣੇ ਘਰ ਲਈ ਕੂਲਰ ਖਰੀਦਿਆ ਪਰ ਉਸਦੀ ਵਰਤੋਂ ਕਰਨ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਇਹ ਤਾਂ ਏ ਸੀ ਨਾਲੋਂ ਬਹੁਤ ਵਧੀਆ ਹੈ ਇਹ ਤਾਂ ਬਹੁਤ ਸਸਤਾ ਹੈ ਅਤੇ ਥੋੜ੍ਹੀ ਦੇਰ ਚਲਾਉਣ 'ਤੇ ਕਮਰਾ ਠੰਡਾ ਕਰ ਦਿੰਦਾ ਹੈ ਅਤੇ ਬਿਜਲੀ ਖਪਤ ਵੀ ਇਸਦੀ ਨਾ ਬਰਾਬਰ ਹੈ ਅਤੇ ਇਸਦੀ ਮੋਟਰ ਵੀ ਬਹੁਤ ਵਧੀਆ ਹੈ ਇਹ ਕੂਲਰ ਬਹੁਤ ਵਧੀਆ ਪਲਾਸਟਿਕ ਦਾ ਬਣਿਆ ਹੋਇਆ ਹੈ ਇਸਦਾ ਅਨੁਭਵ ਬਹੁਤ ਵਧੀਆ ਰਿਹਾ